ਹੈਲੋ ਹਾਂਜੀ ਨਮਸਤੇ ਜੀ ਹਾਂਜੀ ਹਾਂਜੀ ਹਾਂਜੀ ਠੀਕ ਹਾਂ ਦੱਸੋ ਹਾਂਜੀ ਹਾਂਜੀ ਹੈ ਬਹੁਤ ਵਧੀਆ ਹੈ ਉੱਥੇ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਬਾਹਰ ਖਾਣ ਪੀਣ ਨੂੰ ਵੀ ਰੇੜੀਆਂ ਵਗੈਰਾ ਲੋਕ ਵਾਕਿੰਗ ਕਰਦੇ ਆ ਉੱਥੇ ਅਤੇ ਮਤਲਬ ਕਿ ਸਵੇ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਛੋਟਾ ਬੱਚਾ ਹੋਵੇ ਉਹਨੂੰ ਤੁਸੀਂ ਵੋਕਰ ਵਗੈਰਾ 'ਚ ਪਾ ਕੇ ਲੈ ਜੇ ਲੈ ਸਕਦੇ ਹੋ ਬੱਗੀ ਵਗੈਰਾ 'ਚ ਲੈ ਕੇ ਜਾ ਸਕਦੇ ਹੋ ਅਤੇ ਹਾਂਜੀ ਹਾਂਜੀ ਹਾਂਜੀ ਬਹੁਤ ਵਧੀਆ ਉੱਥੇ ਫਿਸ਼ ਵਗੈਰਾ ਨਾ ਸਭ ਉਹਨਾਂ ਨੇ ਬਣਾਈ ਦੀ ਆ ਉੱਥੇ ਲੱਗ ਲੋਕ ਪਾਰਕਿੰਗ ਵਿੱਚ ਫੋਟੋ ਵਗੈਰਾ ਵੀ ਕਰਦੇ ਆ ਅਤੇ ਹਾਂਜੀ ਹੋਰ ਦੀਦੀ ਪਾਰਕ ਦੇ ਅੰਦਰ ਤਾਂ ਨਹੀਂ ਹੈ ਉਹ ਬਾਹਰ ਹੀ ਹੈ ਮਤਲਬ ਰੇੜੀਆਂ ਪਾਰਕ ਦੇ ਅੰਦਰ ਨਹੀਂ ਹੈ ਬਾਹਰ ਹੀ ਰੇੜੀਆਂ ਵਗੈਰਾਂ ਲੱਗੀਆਂ ਹੁੰਦੀਆਂ ਅਤੇ ਮ ਬਰਗਰ ਵਗੈਰਾ ਹਰ ਚੀਜ਼ ਉੱਥੇ ਮਿਲ ਜਾਂਦੀ ਬਾਹਰ ਹਾਂਜੀ ਅੰਦਰ ਕੰਟੀਨ ਹੈ ਉੱਥੇ ਤੁਸੀਂ ਮਤਲਬ ਕਿ ਹੈ ਮੌਸਮ ਦੇ ਹਿਸਾਬ ਨਾਲ ਲੋਕ ਲੱਸੀ ਵਗੈਰਾ ਲੈ ਕੇ ਪੀਂਦੇ ਆ ਮਤਲਬ ਕਿ ਵਧੀਆ ਹੈ ਉੱਥੇ ਕੋਲ ਡਰਿੰਕ ਵਗੈਰਾ ਵੀ ਮਿਲ ਜਾਂਦੀ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮਤਲਬ ਕਿ ਕੋਈ ਵੀ ਇੱਥੇ ਨਵਾਂ ਆਉਂਦਾ ਨਾ ਤਾਂ ਉਹ ਇਹੀ ਪਾਰਕ 'ਚ ਘੁੰਮਣ ਜਾਂਦੇ ਆ ਮਤਲਬ ਕਿ ਕਈ ਤਾਂ ਸਵੇਰੇ ਸੈਰ ਵਗੈਰਾ ਕਰਨ ਜਾਂਦੇ ਆ ਅਤੇ ਮਤਲਬ ਕਿ ਹਾਂਜੀ ਬਹੁਤ ਵਧੀਆ ਪਾਰਕ ਹੈ ਵੈਸੇ ਤਾਂ ਇੱਥੇ ਤਾਂ ਫਿਸ਼ ਪਾਰਕ ਹੀ ਮਸ਼ਹੂਰ ਆ ਜ਼ਿਆਦਾ ਜਿੱਦਾਂ ਸਾਡੇ ਵੀ ਗੈਸਟ ਵਗੈਰਾ ਆਉਂਦੇ ਆ ਤਾਂ ਅਸੀਂ ਉੱਥੇ ਹੀ ਜ਼ਿਆਦਾ ਲੈ ਕੇ ਜਾਂਦੇ ਹਾਂ ਹਾਂਜੀ ਬੱਚੇ ਵੀ ਜ਼ਿਆਦਾ ਉੱਥੇ ਪਸੰਦ ਕਰਦੇ ਜਾਣਾ ਸਾਡੇ ਆਪਣੇ ਖੁਦ ਦੇ ਬੱਚੇ ਸ਼ਾਮ ਨੂੰ ਜਾਂਦੇ ਉੱਥੇ ਹਾਂਜੀ ਹਾਂਜੀ ਨਹੀਂ ਵਧੀਆ ਫਿਸ਼ ਪਾਰਕ ਬਹੁਤ ਮਸ਼ਹੂਰ ਹੈ ਮਤਲਬ ਕਿ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਐ ਫਿਸ਼ ਪਾਰਕ ਬਹੁਤ ਜ਼ਿਆਦਾ ਮਸ਼ਹੂਰ ਆ ਹਾਂ ਕਾਫ਼ੀ ਮਤਲਬ ਕਿ ਉਹਦੇ ਲਾਗੇ ਚਾਗੇ ਵਧੀਆ ਸਵੀਟਸ ਦੀਆਂ ਦੁਕਾਨਾਂ ਵੀ ਹੈ ਮਿੱਠਾ ਮੁੱਠਾ ਵੀ ਮਤਲਬ ਕਿ ਵਧੀਆ ਉੱਥੇ ਛੱਲੀ ਵਗੈਰਾ ਲੱਗੀ ਹੁੰਦੀ ਸ਼ਾਮ ਨੂੰ ਤੋ ਕਿ ਹਾਂਜੀ ਹਾਂਜੀ ਠੀਕ ਹੈ ਓਕੇ ਜੀ